ਖੇਤੀਬਾੜੀ ਵਿੱਚ ਪੰਜਾਬ ਵਿੱਚ ਜੇਕਰ ਦੇਖਿਆ ਜਾਵੇ ਤਾਂ ਅੱਜ ਕੱਲ੍ਹ ਬਹੁਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕੁਝ ਸਮੱਸਿਆਵਾਂ ਤਾਂ ਮੌਸਮ ਨੂੰ ਲੈ ਕੇ ਹਨ ਅਤੇ ਕੁਝ ਬਿਮਾਰੀ ਨੂੰ ਲੈ ਕੇ ਹਨ ਜੇ ਮੌਸਮ ਦੀ ਗੱਲ ਕਰੀਏ ਤਾਂ ਕਹਿ ਸਕਦੇ ਹਾਂ ਕਿ ਜਿਵੇਂ ਸੋਕਾ ਹੋ ਗਿਆ ਜ਼ਿਆਦਾ ਬਰਫ਼ਵਾਰੀ ਹੋ ਗਈ ਜ਼ਿਆਦਾ ਮੀਂਹ ਪੈ ਗਿਆ ਇਸ ਦੇ ਨਾਲ਼ ਫਸਲਾਂ ਦੇ ਖ਼ਰਾਬ ਹੋਣ ਦਾ ਕਾਫ਼ੀ ਡਰ ਬਣਿਆ ਰਹਿੰਦਾ ਹੈ ਅਤੇ ਜੇਕਰ ਗੱਲ ਕਰੀਏ ਆਪਾਂ ਬਿਮਾਰੀ ਦੀ ਤਾਂ ਹਰੇਕ ਫਸਲ ਨੂੰ ਅਲੱਗ ਅਲੱਗ ਕਿਸਮ ਦੀਆਂ ਬਿਮਾਰੀਆਂ ਲੱਗਦੀਆਂ ਹਨ ਇਹਨਾਂ ਲਈ ਅਲੱਗ ਅਲੱਗ ਦਵਾਈਆਂ ਜਾਂ ਕੀਟਨਾਸ਼ਕ ਵਰਤੇ ਜਾਂਦੇ ਹਨ ਪਰੰਤੂ ਫਿਰ ਵੀ ਕਈ ਵਾਰ ਦੇਖਿਆ ਜਾਂਦਾ ਹੈ ਕਿ ਕੀਟਨਾਸ਼ਕਾਂ ਦੇ ਲੋੜ ਤੋਂ ਵੱਧ ਛਿੜਕਾਅ ਦੇ ਨਾਲ਼ ਉਹ ਕੀਟਨਾਸ਼ਕ ਉਸ ਦੇ ਆਦੀ ਹੋ ਜਾਂਦੇ ਹਨ ਅਤੇ ਉਹਨਾਂ ਉੱਤੇ ਕੀਟਨਾਸ਼ਕ ਕੰਮ ਕਰਨਾ ਬੰਦ ਕਰ ਦਿੰਦੇ ਹਨ ਅਤੇ ਅਸੀਂ ਕਹਿ ਸਕਦੇ ਹਾਂ ਕਿ ਇਨ੍ਹਾਂ ਬਿਮਾਰੀਆਂ ਨੂੰ ਸਹੀ ਕਰਨ ਲਈ ਸਾਨੂੰ ਚਾਹੀਦਾ ਹੈ ਕਿ ਕੀਟਨਾਸ਼ਕਾਂ ਦੀ ਵਰਤੋਂ ਘੱਟ ਤੋਂ ਘੱਟ ਕਰੀਏ ਅਤੇ ਜੇਕਰ ਕਰ ਰਹੇ ਹਾਂ ਤਾਂ ਉਸ ਮਿ ਮਿਆਦ ਤੱਕ ਜਾਂ ਉਸ ਲੈਵਲ ਤੱਕ ਹੀ ਕਰੀਏ ਜਿਵੇਂ ਸਾਨੂੰ ਸਰਕਾਰ ਦੁਆਰਾ ਨਿਰਦੇਸ਼ ਦਿੱਤੇ ਜਾਂਦੇ ਹਨ